ਸਤਿ ਸ਼੍ਰੀ ਅਕਾਲ ਜੀ

ਹਾਂਜੀ ਹਾਂਜੀ ਠੀਕ ਆ ਉਸ ਨੇ ਬੜਾ ਵਧੀਆ ਪ ਟੈਸਟ ਦਿੱਤੇ ਸੀਗੇ ਫਸਟ ਯੂਨੀਵਰਸਿਟੀ ਦੇ ਵਿੱਚ ਬਹੁਤ ਵਧੀਆ ਪੜ੍ਹੀ ਆ ਉਹ ਉਹਦੇ ਟੈਸਟ ਦੇਖੇ ਆ ਮੈਂ ਅਤੇ ਠੀਕ ਆ ਮਤਲਬ ਬਹੁਤ ਵਧੀਆ ਨੰਬਰ ਆਏ ਆ ਉਹਦੇ ਅਤੇ ਬਹੁਤ ਮਿਹਨਤ ਕਰਕੇ ਪੜ੍ਹੀ ਹਾਂਜੀ

ਹਾਂਜੀ ਹਾਂਜੀ ਨਹੀਂ ਉਹ ਅਸੀਂ ਕਰ ਰਹੇ ਹਾਂ ਇਸ ਤਰ੍ਹਾਂ ਹੀ ਕਰ ਰਹੇ ਹਾਂ ਅਸੀ ਅਗਾਂਹ ਵਾਸਤੇ ਅਸੀਂ ਕਰਾਂਗੇ ਲੇਕਿਨ ਹੁਣ ਇਸ ਵੇਲੇ ਨਾ ਇਹਨਾਂ ਨੇ ਐਸ ਐਸ ਟੀ 'ਚੋਂ ਪਤਾ ਨਹੀਂ ਕਿਉਂ ਥੋੜ੍ਹਾ ਜਿਹਾ ਪਿੱਛੇ ਰਹਿ ਗਏ ਅਤੇ ਬਾਕੀ ਹਾਂਜੀ ਹਾਂਜੀ ਹਾਂਜੀ

ਹਾਂਜੀ ਨਹੀਂ ਨਹੀਂ ਉਹ ਨਾ ਤੁਸੀਂ ਇਸ ਤਰ੍ਹਾਂ ਕਰੋ ਇਹਨਾਂ ਨੂੰ ਥੋੜ੍ਹਾ ਜਿਹਾ ਐਸ ਐਸ ਟੀ ਦੇ ਵਿੱਚ ਆਪ ਥੋੜ੍ਹਾ ਜਿਹਾ ਧਿਆਨ ਦਿਓ ਬਾਕੀ ਟੈਸਟ ਬਹੁਤ ਵਧੀਆ ਕੀਤੇ ਇਹਨਾਂ ਨੇ ਠੀਕ ਹੈ ਓਕੇ ਓਕੇ ਜੀ ਓਕੇ ਓਕ